ਹੈਲੋ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਕੇਕ ਹੈ ਹੈਗੇ ਨੇ ਤੁਸੀਂ ਮਤਲਬ ਕਿੱਦਾਂ ਦਾ ਕੇਕ ਚਾਹੀਦਾ ਤੁਹਾਨੂੰ ਓਕੇ ਹਾਂਜੀ ਮੈਮ ਪ੍ਰੋਵਾਈਡ ਤਾਂ ਅਸੀਂ ਕਰਵਾ ਸਕਦੇ ਹਾਂ ਅਤੇ ਤੁਹਾਨੂੰ ਮਤਲਬ ਕਿੰਨੀ ਕੁ ਪੋਂਡ ਦਾ ਕੇਕ ਚਾਹੀਦਾ ਅਤੇ ਕਿੰਨੇ ਕੁ ਪ੍ਰਾਈਜ ਤੱਕ ਦਾ ਚਾਹੀਦਾ ਤੁਸੀਂ ਕੁਛ ਦੱਸ ਸਕਦੋ ਹੋ ਮੈਨੂੰ ਮੇਰੀ ਹਿਸਾਬ ਨਾਲ ਤਾਂ ਮਤਲਬ ਤਿੰਨ ਕੁ ਪੋਂਡ ਦਾ ਹੀ ਕੇਕ ਮਤਲਬ ਚੱਲ ਜਾਊਗਾ ਜੇ ਫਿਫਟੀ ਕੁ ਆਉਣਗੇ ਪਰਸਨਜ ਹਾਂਜੀ ਤਿੰਨ ਪੋਨ ਦੇ ਹਿਸਾਬ ਨਾਲ ਅਸੀਂ ਮਤਲਬ ਪੰਦਰਾਂ ਸੌ ਚਾਰਜਸ ਪੇ ਕਰਦੇ ਹਾਂ ਜੇ ਤੁਸੀਂ ਮਤਲਬ ਐਕਸਟਰਾ ਮਤਲਬ ਜੇ ਤੁਸੀਂ ਉਹਦੇ 'ਤੇ ਐਕਸਟਰਾ ਡਿਜ਼ਾਈਨ ਵਗੈਰਾ ਬਣਵਾਉਣਾ ਹੈ ਤਾਂ ਹੋਰ ਕੁਛ ਕਰਵਾਉਣਾ ਤਾਂ ਉਹਦੇ ਅਸੀਂ ਐਕਸਟਰਾ ਚਾਰਜਿਸ ਪੇ ਕਰਦੇ ਹਾਂ ਹਾਂਜੀ ਹਾਂ ਮੈਮ ਫਲੇਵਰ ਤਾਂ ਬਟਰ ਸਕੋਚ ਚੋਕਲੇਟ ਰੈਡ ਵੈਲਵੇਟ ਕੌਣ ਸਾ ਮੈਮ ਉਹ ਤਾਂ ਨਹੀਂ ਹੋ ਪਾਊਗਾ ਮੈਮ ਜਾਂ ਫਿਰ ਜੇ ਤੁਸੀਂ ਸਪੈਸ਼ਲ ਕਸਟਮਾਈਜ ਕਰਵਾਉਣਾ ਕੱਲ੍ਹ ਤੱਕ ਕਰਵਾਉਣਾ ਜਾਂ ਕਦੋਂ ਕਰਵਾਉਣਾ ਓਕੇ ਕੱਲ੍ਹ ਸ਼ਾਮ ਤੱਕ ਚਾਹੀਦਾ ਫਿਰ ਅਸੀਂ ਮਤਲਬ ਮੈਨੂੰ ਪਿੱਛੇ ਪਤਾ ਕਰਨਾ ਪਊਗਾ ਕਿ ਉਹ ਉਦੋਂ ਤੱਕ ਮਤਲਬ ਬਣਾ ਦੇਣਗੇ ਜਾਂ ਨਹੀਂ ਬਣਾ ਦੇਣਗੇ ਹਾਂਜੀ ਮੈਮ ਮੈਂ ਤੁਹਾਨੂੰ ਸੁਜੈਸਟ ਕਰ ਦਿਆਂਂਗੀ ਤੁਸੀਂ ਇੱਕ ਵਾਰ ਸ਼ੋਪ 'ਤੇ ਆ ਕੇ ਵਿਜਿਟ ਕਰ ਲਿਓ ਹਾਂਜੀ ਓਕੇ ਮੈਂ ਤੁਹਾਨੂੰ ਪਿਕਸ ਸੈਂਡ ਕਰ ਦਿੰਦੀ ਹਾਂ ਫਿਰ ਤੁਸੀਂ ਦੇਖ ਲਿਓ

ਓਕੇ ਓਕੇ ਠੀਕ ਹੈ ਓਕੇ ਥੈਂਕ ਯੂ